ਹੈਲੋ ਕੋਲ ਇਜ਼ ਨਾਊ ਬੀਂਗ ਰੀਕੋਰਡਿਡ ਹਾਂਜੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਭਾਅ ਜੀ ਅੱਛਾ ਭਾਅ ਜੀ ਅੱਛਾ ਭਾਅ ਜੀ ਕਿਆ ਪ੍ਰੋਬਲਮ ਕਿਆ ਹੈ ਅੱਛਾ ਸਪਲਾਈ ਦੀ ਪ੍ਰੋਬਲਮ ਹੈ ਕਿੰਨ ਹੈ ਅੱਛ ਕਿੰਨੀਆਂ ਟੂਟੀਆਂ ਖ਼ਰਾਬ ਹੈ ਭਾਅ ਜੀ ਚਾਰ ਟੂਟੀਆਂ ਖ਼ਰਾਬ ਹੈ ਅੱਛਾ ਭਾਅ ਜੀ ਚਾਰ ਟੂਟੀਆਂ ਕ ਨਵੀਆਂ ਪਾ ਦੇਈਏ ਫਿਰ

ਨਹੀਂ ਜੇ ਨਵੀਆਂ ਪਾ ਦੀਏ ਫਿਰ ਪੈਪ ਪੂਪ ਖੋਲ੍ਹ ਕੇ ਨਾ ਸਾਰੀ ਇੱਕ ਵਾਰੀ ਸਪਾਈ ਦੁਬਾਰਾ ਪਾਉਣੀ ਪੈਣੀ ਨਾ ਅੱਛਾ ਸਫਾਈ ਕਰਨੀ ਫਿਰ ਕੋਈ ਨਾ ਭਾਅ ਜੀ ਫਿਰ ਕਰ ਦਿੰਦੇ ਹਾਂ ਸਫਾਈ ਫਿਰ ਹਾਂਜੀ ਸੌ ਰੁਪਇਆ ਲੱਗਣ ਬਈ ਕੋਈ ਨਾ ਭਾਅ ਜੀ ਆ ਆ ਮੈਂ ਹਾਂ ਰਿਹਾ ਕਿੱਧਰ ਹੈ ਭਾਅ ਜੀ ਕਿ ਪਿੰਡ ਆਪਣਾ ਤੌਂਸਾ ਅੱਛਾ ਘਰ ਕਿੱਧਰ ਹੈ ਅੱਛਾ ਭਾਅ ਜੀ ਚੱਲੋ ਠੀਕ ਹੈ ਫਿਰ ਮੈਂ ਨਾ ਫੋਨ ਕਰਦਾ ਤੁਹਾਨੂੰ ਮੈਨੂੰ ਲੈ ਜਿਓ ਮੈਂ ਆ ਰਿਹਾ ਤੁਹਾਡੇ ਕੋਲ ਫਿਰ ਘਰ ਆ ਕੇ ਹਾਂ ਹਾਂਜੀ ਪੱਕਾ ਪਹਿਲਾਂ ਫ ਕਿੱਦਾਂ ਗੱਲ ਹੈ ਫਿਰ ਮੈਂ ਘਰ ਆ ਕੇ ਦੇਖਾਂਗਾ ਨਾ ਕਿਹੜੀ ਕਿਹੜੀ ਟੂਟੀ ਖ਼ਰਾਬ ਹੈ ਜਾਂ ਨਵੀਂ ਪੈਣ ਵਾਲੀ ਹੈ ਕਿਆ ਗੱਲ ਹੈ ਏਦਾਂ ਫਿਰ

ਨਵੀਂ ਭਾਅ ਜੀ ਤਿੰਨ ਸੌ ਦੀ ਟੂਟੀ ਹੈ ਜਿਹੜੀ ਐਲਮੂਨੀਅਮ ਦੀ ਹੈ ਹਾਂਜੀ ਹਾਂਜੀ ਹਾਂਜੀ ਮੈਂ ਕਰ ਦਿੰਦਾ ਫੋਨ ਮੈਂ ਨਾ ਪਹੁੰਚ ਕੇ ਕਰਦਾ ਤੁਹਾਨੂੰ ਠੀਕ